ਹਰ ਇੱਕ ਸਕੂਲ ਵਿੱਚ ਲਾਈਬ੍ਰੇਰੀ ਹੋਣੀ ਜ਼ਰੂਰੀ ਹੁੰਦੀ ਹੈ ਤਾਂ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਪੜ੍ਹਾਈ ਦੀ ਆਦਤ ਪੈ ਜਾਏ ਸੋਹਣੀਆਂ ਕਿਤਾਬਾਂ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪੈ ਜੇ ਮੇਰਾ ਸਕੂਲ ਵੀ ਸਰਹੰਦ ਇੱਕ ਸਰਕਾਰੀ ਸਕੂਲ ਸੀ ਜਿਸ ਵਿੱਚ ਬਹੁਤ ਬੜੀ ਲਾਈਬ੍ਰੇਰੀ ਤਾਂ ਨਹੀਂ ਸੀ ਪਰ ਇੱਕ ਲਾਈਬ੍ਰੇਰੀ ਇੱਕ ਛੋਟੀ ਜਾਂ ਦਰਮਿਆਨੀ ਲਾਈਬ੍ਰੇਰੀ ਆਪਾਂ ਕਹਿ ਸਕਦੇ ਹਾਂ ਜਿਹੜੀ ਹੈਗੀ ਸੀ ਉਹਦੇ 'ਚ ਬਹੁਤ ਸਾਰੀਆਂ ਕਿਤਾਬਾਂ ਸਨ ਜਿਹਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਦੀਆਂ ਕਿਤਾਬਾਂ ਕਹਾਣੀਆਂ ਦੀਆਂ ਕਿਤਾਬਾਂ ਉਂਝ ਪੜ੍ਹਨ ਦੀਆਂ ਸਾਇੰਸ ਦੀਆਂ ਕਿਤਾਬਾਂ ਅੰਗਰੇਜ਼ੀ ਦੀਆਂ ਕਿਤਾਬਾਂ ਬਹੁਤ ਸਾਰੀਆਂ ਕਿਤਾਬਾਂ ਸਨ ਅਸੀਂ ਸਕੂਲ ਦੀਆਂ ਲਾਈਬ੍ਰੇਰੀ ਵਿੱਚੋਂ ਕਈ ਵਾਰੀ ਕਿਤਾਬ ਲੈ ਲੈਣੀ ਸਕੂਲ ਉੱਥੇ ਫਿਰ ਉਹਨੂੰ ਦੋ ਤਿੰਨ ਦਿਨ ਬਾਅਦ ਵਾਪਸ ਕਰਨਾ ਹੁੰਦਾ ਸੀਗਾ ਅਤੇ ਉਹਨੂੰ ਫਿਰ ਵਾਪਸ ਕਰ ਦੇਣਾ ਪੜ੍ਹਨਾ ਕਿਉਂਕਿ ਸਾਡੇ ਬਚਪਨ 'ਚ ਇਹ ਮੋਬਾਈਲ ਜਾਂ ਇਹੋ ਜਿਹੀਆਂ ਇੰਟਰਨੈਟ ਇਹੋ ਜਿਹੀਆਂ ਚੀਜ਼ਾਂ ਤਾਂ ਹੈ ਨਹੀਂ ਸੀ ਤਾਂ ਫਿਰ ਬੱਚਿਆਂ ਨੂੰ ਲਾਈਬ੍ਰੇਰੀ 'ਚੋਂ ਕੋਈ ਨਾ ਕੋਈ ਕਿਤਾਬ ਲੈ ਆਉਣੀ ਕਿਤਾਬਾਂ ਲੈ ਕੇ ਪੜ੍ਹਨੀਆਂ ਕਈ ਕਿਤਾਬਾਂ ਜਿਵੇਂ ਕਿ ਸਾਡੀ ਲਾਈਬ੍ਰੇਰੀ 'ਚ ਬਹੁਤ ਸਾਰੀਆਂ ਕਿਤਾਬਾਂ ਬ ਗੁਰੂਆਂ ਦੀਆਂ ਸਾਖੀਆਂ 'ਤੇ ਹੁੰਦੀਆਂ ਸੀ ਮੈਨੂੰ ਯਾਦ ਹੈ ਗੁਰੂ ਨਾਨਕ ਦੇਵ ਜੀ ਦੀਆਂ ਤ ਸਾਖੀਆਂ ਬਹੁਤ ਸਨ ਕਿਤਾਬਾਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਕਿਤਾਬਾਂ ਹੁੰਦੀਆਂ ਸੀ ਦਸਾਂ ਗੁਰੂਆਂ ਦੀਆਂ ਜੀਵਨੀਆਂ ਬਾਰੇ ਕਿਤਾਬਾਂ ਭਗਤ ਸਿੰਘ 'ਤੇ ਕਿਤਾਬਾਂ ਊਧਮ ਸਿੰਘ 'ਤੇ ਕਿਤਾਬਾਂ ਸੀ ਜਾਂ ਫਿਰ ਕਈ ਵਾਰੀ ਕੋਈ ਕਹਾਣੀਆਂ ਛੋਟੀਆਂ ਕਹਾਣੀਆਂ ਜਿਹੜੀਆਂ ਜਿਹਨਾਂ ਨੂੰ ਆਪਾਂ ਛੋਟੀਆਂ ਕਹਾਣੀਆਂ ਕਹਿ ਸਕਦੇ ਸੀ ਆਮ ਜੀਵਨ ਵਾਲੀਆਂ ਕਹਾਣੀਆਂ ਵੀ ਸੀ ਜਿਹੜੀਆਂ ਪੜ੍ਹਦੇ ਸੀਗੇ ਜਾਂ ਫਿਰ ਕੋਈ ਕਈ ਸਾਇੰਸ ਦੀਆਂ ਕਿਤਾਬਾਂ ਵੀ ਹੁੰਦੀਆਂ ਸੀ ਜਿਹੜੀਆਂ ਕਿ ਇੰਟਰਸਟਿੰਗ ਲੱਗਦੀਆਂ ਸੀ ਅਤੇ ਆਪਾਂ ਉਹ ਵੀ ਪੜ੍ਹਦੇ ਸੀ ਬਚਪਨ 'ਚ ਬਚਪਨ 'ਚ ਮੈਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਵਾਲੀਆਂ ਕਿਤਾਬਾਂ ਬਹੁਤ ਹੀ ਵਧੀਆ ਲੱਗਦੀਆਂ ਸੀ ਪੜ੍ਹਨੀਆਂ ਅਤੇ ਉਹ ਮੈਨੂੰ ਅੱਜ ਵੀ ਯਾਦ ਨੇ ਕਿ ਉਹਨਾਂ ਵਿੱਚ ਕਿਹੜੀਆਂ ਕਿਹੜੀਆਂ ਸਾਖੀਆਂ ਸੀ ਬਚਪਨ ਦੀਆਂ ਪੜ੍ਹੀਆਂ ਹੋਈਆਂ ਮੈਂ ਅੱਜ ਵੀ ਉਹ ਸਾਖੀ ਆਪਣੀ ਬੇਟੀ ਨੂੰ ਪੜ੍ਹ ਕੇ ਸੁਣਾਉਂਦੀ ਹਾਂ ਅਤੇ ਉਹ ਵੀ ਬੜੇ ਧਿਆਨ ਨਾਲ ਸੁਣਦੀ ਹੈ